ਮੈਂ ਆਪਣੇ ਰੋਜ਼ਾਨਾ ਰੂਟੀਨ ਵਿੱਚ ਯੋਗਾ ਨੂੰ ਇਸ ਤਰ੍ਹਾਂ ਸ਼ਾਮਿਲ ਕਰਦੀ ਹਾਂ ਕਿ ਪਹਿਲਾਂ ਤਾਂ ਮੈਂ ਸਵੇਰੇ ਜਲਦੀ ਉੱਠ ਕੇ ਬਾਹਰ ਤਾਜ਼ੀ ਹਵਾ ਵਿੱਚ ਯੋਗਾ ਕਰਦੀ ਹਾਂ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਮੌਸਮ ਠੰਡਾ ਹੋ ਜਾਂਦਾ ਹੈ ਤਾਂ ਉਸ ਵੇਲੇ ਵੀ ਯੋਗਾ ਕਰਦੀ ਹਾਂ ਯੋਗਾ ਕਰਨ ਦੇ ਨਾਲ ਸਰੀਰ ਵਿੱਚ ਚੁਸਤੀ ਫੁਰਤੀ ਆਉਂਦੀ ਹੈ ਅਤੇ ਜੋ ਸਾਨੂੰ ਬਿਮਾਰੀਆਂ ਲੱਗੀਆਂ ਹੁੰਦੀਆਂ ਹਨ ਉਹਨਾਂ ਤੋਂ ਵੀ ਛੁਟਕਾਰਾ ਮਿਲਦਾ ਹੈ ਅਸੀਂ ਬਹੁਤ ਸਾਰੀਆਂ ਅੰਗਰੇਜ਼ੀ ਦਵਾਈਆਂ ਖਾਂਦੇ ਹਾਂ ਜਿਹਨਾਂ ਦਾ ਸਾਡੇ ਸਰੀਰ 'ਤੇ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਹੈ ਜੇਕਰ ਅਸੀਂ ਯੋਗਾ ਨੂੰ ਆਪਣੇ ਰੋਜ਼ਾਨਾ ਰੂਟੀਨ ਵਿੱਚ ਸ਼ਾਮਿਲ ਕਰ ਲਈਏ ਤਾਂ ਇਸ ਦੇ ਨਾਲ ਅਸੀਂ ਦਵਾਈਆਂ ਤੂੰ ਤਾਂ ਛੁਟਕਾਰਾ ਪਾਵਾਂਗੇ ਹੀ ਨਾਲ ਦੀ ਨਾਲ ਸਾਡੇ ਸਰੀਰ ਵਿੱਚ ਚੁਸਤੀ ਅਤੇ ਫੁਰਤੀ ਵੀ ਆਵੇਗੀ